ਪੇਂਡੂ ਖੇਤਰਾਂ ਵਿੱਚ ਸਰਕਾਰੀ ਸ਼ਾਸਨ ਵਿੱਚ ਗਰੇਡ ਅਤੇ ਲਿੰਗ ਮੁਤਾਬਿਕ ਕੁੜੀਆਂ ਦੀ ਪੜ੍ਹਨ ਦੀ ਸਮਰੱਥਾ ਮੁੰਡਿਆਂ ਨਾਲ ਬਿਹਤਰ ਹੈ ਤੀਜੀ ਜਮਾਤ ਵਿੱਚ ਮੁੰਡਿਆਂ ਦੀ ਪੜ੍ਹਨ ਦੀ ਸਮਰੱਥਾ ਦੋ ਹਜ਼ਾਰ ਬਾਈ ਵਿੱਚ ਉਣੱਤੀ ਪੁਆਇੰਟ ਪੰਜ ਫੀਸਦ ਸੀ ਜਦਕਿ ਦੋ ਹਜ਼ਾਰ ਚੌਵੀ ਵਿੱਚ ਇਹ ਇਕੱਤੀ ਪੁਆਇੰਟ ਨੌਂ ਫੀਸਦ 'ਤੇ ਪੁੱਜ ਗਈ ਹੈ ਦੂਜੇ ਪਾਸੇ ਤੀਜੀ ਜਮਾਤ ਦੀਆਂ ਕੁੜੀਆਂ ਵਿੱਚ ਪੜ੍ਹਨ ਦੀ ਸਮਰੱਥਾ ਦੋ ਹਜ਼ਾਰ ਬਾਈ ਵਿੱਚ ਠ ਛੱਤੀ ਪੁਆਇੰਟ ਅੱਠ ਫੀਸਦ ਸੀ ਅਤੇ ਦੋ ਹਜ਼ਾਰ ਚੌਵੀ ਵਿੱਚ ਇਹ ਘੱਟ ਕੇ ਛੱਤੀ ਪੁਆਇੰਟ ਛੇ ਫੀਸਦ ਰਹਿ ਗਈ ਹੈ ਮਿਡ ਡੇ ਮੀਲ ਸਣੇ ਕਈ ਖੇਤਰਾਂ ਵਿੱਚ ਪੰਜਾਬ ਦੇ ਸਕੂਲਾਂ ਦੀ ਸਥਿਤੀ ਕੌਮੀ ਅੰਕੜਿਆਂ ਨਾਲੋਂ ਬਿਹਤਰ ਵੀ ਹੈ ਕੌਮੀ ਪੱਧਰ 'ਤੇ ਨੌਂ ਪੁਆਇੰਟ ਨੌਂ ਫੀਸਦ ਸਕੂਲਾਂ ਵਿੱਚ ਮਿਡ ਡੇ ਮੀਲ ਦਿੱਤੀ ਜਾਂਦੀ ਹੈ ਜਦਕਿ ਪੰਜਾਬ ਦੇ ਚਰਾਨਵੇਂ ਪੁਆਇੰਟ ਸਤਾਨਵੇਂ ਪੁਆਇੰਟ ਚਾਰ ਫੀਸਦ ਸਕੂਲਾਂ ਵਿੱਚ ਮਿਡ ਡੇ ਮੀਲ ਦਿੱਤੀ ਜਾ ਰਹੀ ਹੈ